ਮੈਂ ਮਾਨਸਾ ਦੀ ਰਹਿਣ ਵਾਲੀ ਆਂ ਅਤੇ ਮੈਂ ਚੰਡੀਗੜ੍ਹ ਜਾਣ ਲਈ ਤੁਹਾਡੇ ਟਰਾਂਸਪੋਰਟ ਏਜੰਸੀ ਤੋਂ ਇੱਕ ਕੈਬ ਬੁੱਕ ਕੀਤੀ ਤੇ ਤੁਹਾਨੂੰ ਜਿਵੇਂ ਪਤਾ ਹੀ ਐ ਅੱਜ ਕੱਲ ਦੇ ਟਾਈਮ ਵਿੱਚ ਬਿਮਾਰੀਆਂ ਬਹੁਤ ਫੈਲ ਰਹੀਆਂ ਹਨ ਜੇ ਇੱਕ ਉਹਨਾਂ ਵਿੱਚੋਂ ਇੱਕ ਕਰੋਨਾ ਵੀ ਹੈ ਕਰੋਨਾ ਤੁਹਾਨੂੰ ਪਤਾ ਹੀ ਐ ਟੱਚ ਕਰਨ ਨਾਲ ਯਾ ਇੱਕ ਦੂਜੇ ਦੇ ਨਾਲ ਨੇੜੇ ਹੋਣ ਨਾਲ ਫੈਲਦਾ ਹੈ ਤੇ ਜੇ ਲੋਕਾਂ ਨੂੰ ਵੀ ਅੱਗੋਂ ਸਰਕਾਰ ਨੇ ਇਹ ਸਲਾਹ ਦਿੱਤੀ ਹੈ ਕਿ ਜਿੱਥੇ ਵੀ ਤੁਸੀਂ ਜਾਓ ਮਾਸਕ ਲਗਾ ਕਰ ਹੀ ਜਾਓ ਤੇ ਦੂਰੀ ਬਣਾਏ ਰੱਖੋ ਪਰ ਤੁਹਾਡੇ ਭੇਜੇ ਹੋਏ ਕੈਬ ਡਰਾਈਵਰ ਨੇ ਮਾਸਕ ਵੀ ਨਹੀਂ ਲਗਾ ਰੱਖਿਆ ਸੀ ਅਤੇ ਡਰਾਈ ਕੈਬ ਵਿੱਚ ਬਹੁਤ ਹੀ ਜ਼ਿਆਦਾ ਗੰਦਗੀ ਸੀ ਜਿਸ ਕਰਕੇ ਮੈਨੂੰ ਬਹੁਤ ਜਿਆਦਾ ਤਕਲੀਫ ਹੋਈ ਅਤੇ ਜਦੋਂ ਕੈਬ ਡਰਾਈਵਰ ਨੂੰ ਕਿਹਾ ਗਿਆ ਕਿ ਤੁਸੀਂ ਮਾਸਕ ਲਗਾਓ ਤਾਂ ਉਹਨਾਂ ਨੇ ਸਾਫ ਮਨਾ ਕਰ ਦਿੱਤਾ ਕੀ ਉਹ ਮਾਸਕ ਨਹੀਂ ਲਗਾਣਗੇ ਤੇ ਜਿਸ ਕਰਕੇ ਮਤਲਬ ਕੀ ਤੁਹਾਨੂੰ ਤਾਂ ਸਾਨੂੰ ਬਹੁਤ ਦਿੱਕਤ ਆਈ ਤੇ ਸਫਾਈ ਜਦੋਂ ਕੈਬ ਸਾਫ ਕਰਨ ਦਾ ਕਿਹਾ ਤਾਂ ਵੀ ਉਹਨਾਂ ਨੇ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਤੁਹਾਨੂੰ ਜਿਵੇਂ ਤੁਹਾਨੂੰ ਹੀ ਮਤਲਬ ਕੀ ਅਰੇਂਜ ਕਰਨਾ ਪਊਗਾ ਜਿੱਥੇ ਤੁਸੀਂ ਬਹਿਣ ਆ ਤਾਂ ਬੈਠੋ ਨੀ ਤਾਂ ਤੁਸੀਂ ਕੋਈ ਹੋਰ ਕੈਬ ਬੁੱਕ ਕਰ ਲਓ ਜਾਂ ਮੈਂ ਤੁਹਾਨੂੰ ਚਾਹੁੰਦੀ ਆ ਕੀ ਤੁਸੀਂ ਇਸ ਤੇ ਡਰਾਈਵਰ ਨੂੰ ਜਾਂ ਤਾਂ ਸਮਝਾਇਆ ਜਾਵੇ ਜਾਂ ਉਸਨੂੰ ਉਸਤੇ ਕੜੇ ਐਕਸ਼ਨ ਲਿੱਤੇ ਜਾਣ ਤਾਂ ਕੀ ਜੋ ਉਨੇ ਬਦਤਮੀਜ਼ੀ ਕੀਤੀ ਐ ਉਹ ਹੋਰ ਕਿਸੇ ਨਾਲ ਨਾ ਕਰੇ ਅਤੇ ਉਹ ਸਾਰ ਮਾਸਕ ਵੀ ਲਗਾਵੇ ਅਤੇ ਇਸ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਵੀ ਜਾ ਸਕੇ ਧੰਨਵਾਦ ਜੀ